ਹੈਲੋ ਹਾਂਜੀ ਗੁੱਡ ਮੋਰਨਿੰਗ ਹਾਂਜੀ ਹਾਂਜੀ ਹਾਂਜੀ ਦੱਸੋ ਕੀ ਕੰਮ ਸੀਗਾ

ਅੱਛਾ ਜੀ ਅੱਛਾ ਜੀ ਅੱਛਾ ਜੀ ਫੇਰ ਮਤਲਬ ਤੁਹਾਨੂੰ ਉਹ ਅੱਛਾ ਜੀ ਉਹ ਡੀਲਰ ਦਾ ਮਤਲਬ ਤੁਹਾਡੇ ਕੋਲ ਹੈਗਾ ਕੁਛ ਨਾਮ ਪਤਾ ਕਿੱਥੋਂ ਦਾ ਹੈਗਾ ਉਹ ਅੱਛਾ ਕਿੱਥੋਂ ਦਾ ਰਹਿਣ ਵਾਲਾ ਅੱਛਾ ਜੀ ਪਹਿਲੇ ਕੋਈ ਪ੍ਰੋਪਰਟੀ ਲਈ ਹੈ ਉਹਦੇ ਕੋਲ ਤੁਸੀਂ ਕਦੇ ਜਾਂ ਤੁਹਾਡੇ ਆ ਜਾਣ ਪਛਾਣ ਦੇ ਕਿਸੇ ਨੇ ਲਈ ਹੋਵੇ ਅੱਛਾ ਅੱਛਾ ਜੀ ਅੱਛਾ ਅਤੇ ਤੁਸੀਂ ਇੱਦਾਂ ਕਰੋ ਮੈਨੂੰ ਨਾ ਉਸ ਬੰਦੇ ਦੀ ਮਤਲਬ ਪ੍ਰੋਪਰਟੀ ਡੀਲਰ ਦੀ ਫੋਟੋ ਔਰ ਨਾਮ ਵਗੈਰਾ ਇੱਕ ਪੇਜ਼ 'ਤੇ ਉਹਦਾ ਵੇਰਵਾ ਥੋੜ੍ਹਾ ਜਿਹਾ ਲਿਖ ਕੇ ਅਤੇ ਸੈਂਡ ਕਰ ਦਿਓ ਅਸੀਂ ਪਹਿਲੇ ਤਾਂ ਉਹਨੂੰ ਮਤਲਬ ਸੱਮਨ ਭੇਜਦੇ ਹਾਂ ਠੀਕ ਹੈ ਅਗਰ ਤਾਂ ਉਹ ਨਹੀਂ ਮੰਨਦਾ ਫੇਰ ਅਸੀਂ ਉਹ 'ਤੇ ਪੁਲਿਸ ਕਾਰਵਾਈ ਕਰਾਂਗੇ ਠੀਕ ਹੈ ਪਹਿਲੇ ਤੁਸੀਂ ਉਹਨੂੰ ਮੈਨੂੰ ਉਹਦਾ ਫੋਟੋ ਵਗੈਰਾ ਤੁਸੀਂ ਭੇਜ ਦਿਓ ਅਤੇ ਗੱਲ ਕਰਕੇ ਦੇਖਦੇ ਹਾਂ ਉਹਨਾਂ ਨਾਲ ਧੋਖੇਬਾਜੀ ਇਹ ਪਹਿਲੇ ਤਾਂ ਨਹੀਂ ਕਦੇ ਹੋਈ ਕਿਸੇ ਦੇ ਨਾਲ ਜਿੱਦਾਂ ਤੁਹਾਡੇ ਆਂ ਆਂਢ ਗੁਆਂਢ ਵਿੱਚ ਕਿਸੇ ਨੇਬਰ ਵਿੱਚ ਹਮ ਹਮ ਚਲੋ ਠੀਕ ਕੋਈ ਨਾ ਤੁਸੀਂ ਕਰੋ ਮੈਂ ਕਰਦੀ ਹਾਂ ਫਿਰ ਅੱਗੇ ਦਾ ਕੰਮ ਠੀਕ ਹੈ ਹਾਂ ਸਾਡਾ ਓਫਿਸ ਜੀ ਇਹ ਸੁੰਦਰ ਨਗਰ 'ਚ ਹੈਗਾ ਠੀਕ ਹੈ ਇੰਦਰਾ ਵਾਲੇ ਹੈ ਨਾ ਉਹਨਾਂ ਦੇ ਨੇੜੇ ਜੇ ਹਾਂਜੀ ਤੁਸੀਂ ਫੋਨ 'ਤੇ ਮੈਨੂੰ ਵਟਸਐਪ 'ਤੇ ਮੈਂ ਇਸੀ ਨੰਬਰ ਫੀਸ ਦੇਖੋ ਜੀ ਫੀਸ ਤਾਂ ਹੈਗੀ ਏ ਟੈਨ ਥਾਊਸੰਡ ਹੈਗੀ ਹੈ ਮੇਰੀ ਪਹਿਲੇ ਤੁਸੀਂ ਸਮਨ ਭੇਜ ਦਿਓ ਉਸ ਤੋਂ ਬਾਅਦ ਬਾਕੀ ਦੇਖਦੇ ਹਾਂ ਕਿੰਨਾ ਕ ਲੰਬਾ ਕੇਸ ਜਾਊਗਾ ਉਸ ਹਿਸਾਬ ਨਾਲ ਅਸੀਂ ਡਿਸਾਇਡ ਕਰਾਂਗੇ